ਹਾਂ ਮੈਂ ਮੀਡੀਆ ਬਾਰੇ ਬਹੁਤ ਕੁਝ ਜਾਣਦਾ ਹਾਂ ਅਤੇ ਵਧੀਆ ਸੋਚਦਾ ਹਾਂ ਇਹ ਸਾਨੂੰ ਬਹੁਤ ਸਾਰੀਆਂ ਖਬਰਾਂ ਦੱਸਦੀਆਂ ਹਨ ਸਾਡੇ ਮਸ਼ਹੂਰ ਅਖਬਾਰ ਅਜੀਤ ਅਤੇ ਨਿਊਜ਼ ਚੈਨਲ ਪੀ ਟੀ ਸੀ ਹਨ